ਮੈਂ ਕਾਫੀ ਘੱਟ ਚੀਜ਼ ਹੀ ਔਨਲਾਈਨ ਮੰਗਾਉਂਦਾ ਹਾਂ ਕਿਉਂਕਿ ਮੈਨੂੰ ਇਹੋ ਜਿਹੀ ਚੀਜ਼ਾਂ 'ਤੇ ਭਰੋਸਾ ਨਹੀਂ ਹੁੰਦਾ ਪਰ ਆਹ ਜਦੋਂ ਮੈਂ ਦਿਵਾਲੀ ਦੀ ਸੇਲਸ ਵਿੱਚ ਜ਼ਿਆਦਾ ਡਿਸਕਾਊਂਟ ਵਿੱਚ ਇੱਕ ਹੈਡਫੋਨਸ ਮੰਗਵਾਏ ਸਨ ਜੋ ਕਿ ਬੋਟ ਦੇ ਹਨ ਅਤੇ ਉਹ ਜੇ ਸੈਵਨ ਬਾਰਾਂ ਹਜ਼ਾਰ ਦੇ ਪਏ ਹਨ ਸਾਨੂੰ ਇਸ ਦਾ ਪਹਿਲੇ ਰੇਟ ਕਾਫੀ ਹਾਈ ਲੱਗਿਆ ਪਰ ਦਿਵਾਲੀ ਦੀ ਸੇਲਸ ਕਾਰਨ ਇਹ ਸਾਨੂੰ ਅੱਠ ਹਜ਼ਾਰ ਦੇ ਮਿਲ ਗਏ ਹਨ ਅਤੇ ਅਸੀਂ ਇਸ ਨੂੰ ਦੇਖ ਕੇ ਕਾਫੀ ਖੁਸ਼ ਹੋਏ ਅਸੀਂ ਜਦੋਂ ਇਹ ਇਹ ਇਹ ਪ੍ਰੋਡਕਟ ਸਾਡੇ ਘਰ ਤਿੰਨ ਦਿਨਾਂ ਵਿੱਚ ਆ ਗਿਆ ਸੀ ਅਤੇ ਮੈਂ ਇਸ ਦੀ ਬਣਾਵਟ ਦੇਖ ਕੇ ਕਾਫੀ ਪ੍ਰਸੰਨ ਹੋਇਆ ਆਹ ਜਦੋਂ ਮੈਂ ਦੇਖਿਆ ਤਾਂ ਇਹ ਕਾਫੀ ਵਧੀਆ ਸੀ ਅਤੇ ਇਸ ਦੀ ਆਵਾਜ਼ ਦੀ ਕੁਆਲਿਟੀ ਵੀ ਕਾਫੀ ਚੰਗੀ ਸੀ ਇਸ ਦੀ ਬੇਸ ਦਾ ਤਾਂ ਪੁੱਛੋ ਹੀ ਨਾ ਇਹ ਬਹੁਤ ਹੀ ਵਧੀਆ ਸੀ ਇਸ ਦੀ ਬੇਸ ਬਹੁਤ ਵਧੀਆ ਸੀ ਸਾਨੂੰ ਇਸ ਪ੍ਰੋਡੈਕਟ ਕਾਫੀ ਪਸੰਦ ਆਇਆ ਅਤੇ ਅਸੀਂ ਇਸ ਨੂੰ ਰੱਖ ਲਿਆ ਸਾਂਤੇ ਅਸੀਂ ਇਸ ਨੂੰ ਪੰਜ ਸਟਾਰ ਦੀ ਰੇਟਿੰਗ ਵੀ ਦਿੱਤੀ ਸਾਨੂੰ ਫਲਿੱਪਕਾਰਟ ਤੋਂ ਮਿਲਿਆ ਹੋਇਆ ਇਹ ਪ੍ਰੋਡਕਟ ਕਾਫੀ ਚੰਗਾ ਲੱਗਿਆ ਅਤੇ ਮੇਰੇ ਘਰ ਦੇ ਸਦੱਸਿਆ ਨੇ ਵੀ ਇਸ ਨੂੰ ਕਾਫੀ ਪਸੰਦ ਕੀਤਾ ਅਤੇ ਉਸ ਦਿਨ ਤੋਂ ਬਾਅਦ ਅਸੀਂ ਔਨਲਾਈਨ ਚੀਜ਼ਾਂ ਮੰਗਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਇਹ ਹੈਡਫੋਨ ਕਾਫੀ ਵਧੀਆ ਹਨ ਇਹਨਾਂ ਨੂੰ ਹੁਣ ਸਾਲ ਹੋਣ ਲੱਗਾ ਹੈ ਅਤੇ ਇਹ ਹੁਣ ਵੀ ਨਵੇਂ ਦੇ ਨਵੇਂ ਪਏ ਹਨ ਇਸ ਦਾ ਪ੍ਰਯੋਗ ਅਸੀਂ ਪੜ੍ਹਾਈ ਵਿੱਚ ਵੀ ਕਰ ਸਕਦੇ ਹਾਂ ਅਤੇ ਅਸੀਂ ਯੂਟੀਊਬ ਵਿੱਚ ਵੀਡੀਓਜ਼ ਵੀ ਦੇਖ ਸਕਦੇ ਹਾਂ ਅਤੇ ਇਹ ਹੈਡਫੋਨ ਦੇ ਬਾਹਰ ਥੋੜ੍ਹੀ ਜਿਹੀ ਵੀ ਆਵਾਜ਼ ਨਹੀਂ ਜਾਂਦੀ ਜੋ ਕਿ ਕਾਫੀ ਵਧੀਆ ਗੱਲ ਹੈ ਅਤੇ ਅਸੀਂ ਅਲੱਗ ਤੋਂ ਬੈਠ ਕੇ ਫਿਲਮਾਂ ਵੀ ਦੇਖ ਸਕਦੇ ਹਾਂ ਜਿਸ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਵੀ ਨਹੀਂ ਹੋਏਗੀ ਅਤੇ ਅਸੀਂ ਆਪਣਾ ਮਜ਼ਾ ਕਰ ਸਕਦੇ ਹਾਂ ਇਸ ਦੀ ਕੁਆਲਿਟੀ ਕਾਫੀ ਮਜਬੂਤ ਹੈ ਅਤੇ ਆਹ ਕਾਫੀ ਚੰਗੇ ਮਟੀਰੀਅਲ ਨਾਲ ਬਣਿਆ ਹੋਇਆ ਹੈ ਅਤੇ ਆਹ ਮੇਰਾ ਬਹੁਤ ਬਹੁਤ ਮਨਪਸੰਦੀ ਦਾ ਗੈਜਟ ਹੈ ਅਤੇ ਮੈਨੂੰ ਇਹ ਕਾਫੀ ਪਸੰਦ ਹੈ